ਰੂਪਨਗਰ ਜ਼ਿਲ੍ਹਾ ਜੋ ਹੈ ਪੰਜਾਬ ਦਾ ਕੇਂਦਰੀ ਅਤੇ ਸਭ ਤੋਂ ਵਿਕਸਿਤ ਜ਼ਿਲ੍ਹਾ ਹੈ ਇਸ ਨੂੰ ਰੋਪੜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੇਕਰ ਮੈਂ ਇਸ ਦੇ ਇਤਿਹਾਸ ਦੀ ਗੱਲ ਕਰਾਂ ਤਾਂ ਰੂਪਨਗਰ ਜੋ ਹੈ ਸਿੰਧੂ ਘਾਟੀ ਸੱਭਿਅਤਾ ਦੇ ਨਾਮ ਤੋਂ ਵੀ ਬਹੁਤ ਹੀ ਪ੍ਰਸਿੱਧ ਹੈ ਇੱਥੇ ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਬਹੁਤ ਸਾਰੀ ਜਾਣਕਾਰੀਆਂ ਉਸ ਪੁਰਾਣੇ ਸਮੇਂ ਵਿੱਚ ਕਿਵੇਂ ਦਾ ਲੋਕਾਂ ਦਾ ਜੋ ਰਹਿਣ ਸਹਿਣ ਸੀ ਉਹਨਾਂ ਦਾ ਜੋ ਵਪਾਰ ਸੀ ਉਸ ਬਾਰੇ ਜਾਣਕਾਰੀ ਮਿਲ ਜਾਂਦੀ ਹੈ ਸਾਡੇ ਰੂਪਨਗਰ ਜ਼ਿਲ੍ਹੇ ਵਿੱਚ ਇੱਕ ਅਜਾਇਬ ਘਰ ਹੈ ਜਿੱਥੇ ਪੁਰਾਣੇ ਅ ਇਤਿਹਾਸਿਕ ਸਮਿਆਂ ਨਾਲ ਰਿਲੇ ਰਿਲੇਟਿਡ ਜੋ ਵੀ ਵਸਤੂਆਂ ਹਨ ਜੋ ਵੀ ਹਥਿਆਰ ਹਨ ਉਹ ਸਭ ਉਥੇ ਰੱਖੇ ਗਏ ਹਨ ਜੋ ਕਿ ਸਾਨੂੰ ਹਿਸ ਇਤਿਹਾਸ ਬਾਰੇ ਜਾਣਕਾਰੀ ਭਰਪੂਰ ਤਰੀਕੇ ਨਾਲ ਦੇ ਸਕਦੇ ਹਨ ਇਸ ਤੋਂ ਇਲਾਵਾ ਜੇਕਰ ਮੈਂ ਇਸ ਦੇ ਵਿਕਾਸ ਦੀ ਗੱਲ ਕਰਾਂ ਤਾਂ ਕੁਝ ਸਾਲਾਂ ਵਿੱਚ ਰੂਪਨਗਰ ਵਿਚ ਬਹੁਤ ਜ਼ਿਆਦਾ ਤੇਜ਼ੀ ਨਾਲ ਵਿਕਾਸ ਦੇਖਿਆ ਗਿਆ ਹੈ ਬਹੁਤ ਸਾਰੀ ਚੀਜ਼ਾਂ ਵਿਕਸਿਤ ਹੋਈਆਂ ਹਨ ਜਿਵੇਂ ਕਿ ਕੰਮਕਾਰ ਲਈ ਵੀ ਗੱਲ ਕਰੀਏ ਖੇਤੀਬਾੜੀ ਦੇ ਖੇਤਰ ਵਿੱਚ ਪਹਿਲਾਂ ਲੋਕ ਹੱਥਾਂ ਨਾਲ ਹੀ ਕੰਮ ਕਰਦੇ ਹੁੰਦੇ ਸੀ ਪਰ ਅੱਜ ਦੇ ਸਮੇਂ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਵੀ ਉਪਲਬਧ ਹੋ ਗਈਆਂ ਹਨ ਜਿਸ ਨਾਲ ਉਨ੍ਹਾਂ ਨੂੰ ਖੇਤੀਬਾੜੀ ਕਰਨ ਵਿੱਚ ਬਹੁਤ ਆਸਾਨੀ ਹੋ ਜਾਂਦੀ ਹੈ ਜੇਕਰ ਮੈਂ ਮਾਰਕੀਟ ਦੀ ਹੋਰ ਸਾਰੀ ਦੁਕਾਨਾਂ ਜਾਂ ਫਿਰ ਜ਼ਿਆਦਾਤਰ ਖਾਣ ਪੀਣ ਦੇ ਰੈਸਟੋਰੈਂਟ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਹੋਟਲ ਰੈਸਟੋਰੈਂਟ ਅੱਜ ਦੇ ਸਮੇਂ ਵਿੱਚ ਵਿਕਸਿਤ ਹੋ ਗਏ ਹਨ ਜੋ ਕਿ ਪਹਿਲਾਂ ਕਿਤੇ ਨਾ ਕਿਤੇ ਲੋਕਾਂ ਨੂੰ ਰੂਪਨਗਰ ਦੇ ਪਾਸ ਦੇ ਸ਼ਹਿਰ ਵਿੱਚ ਜਿਵੇਂ ਕਿ ਚੰਡੀਗੜ੍ਹ ਵਿੱਚ ਜਾਣਾ ਪੈਂਦਾ ਸੀਗਾ ਪਰ ਅੱਜ ਦੇ ਸਮੇਂ ਵਿੱਚ ਡੋਮੀਨੋਜ਼ ਸਬਵੇਅ ਮੈਕਡੋਨਲਜ਼ ਵਰਗੇ ਰੈਸਟੋਰੈਂਟ ਸਾਡੇ ਰੂਪਨਗਰ ਜ਼ਿਲ੍ਹੇ ਵਿੱਚ ਹੀ ਉਪਲਬਧ ਹੋ ਗਏ ਹਨ ਖੁੱਲ੍ਹੇ ਜਾ ਚੁੱਕੇ ਹਨ ਜਿਸ ਨਾਲ ਲੋਕਾਂ ਨੂੰ ਬਾਹਰ ਜਾਣ ਲਈ ਸੋਚਣਾ ਨਹੀਂ ਪੈਂਦਾ ਹੈ ਉਹ ਆਪਣੇ ਸ਼ਹਿਰ ਵਿੱਚ ਆਪਣੇ ਰੂਪਨਗਰ ਜ਼ਿਲ੍ਹੇ ਵਿੱਚ ਰਹਿ ਕਰ ਹੀ ਉਸਦਾ ਲੁਤਫ਼ ਉਠਾ ਸਕਦੇ ਹਨ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਕਿਸੇ ਪ੍ਰਸਿੱਧ ਇਤਿਹਾਸਕ ਸ਼ਖਸ਼ੀਅਤ ਦੀ ਤਾਂ ਮੈਂ ਰਾਜਾ ਰਾਕੇਸ਼ਰ ਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਇਹ ਰਾਜਾ ਉਹ ਸਨ ਜਿਨ੍ਹਾਂ ਨੇ ਰੂਪਨਗਰ ਜ਼ਿਲ੍ਹੇ ਦੀ ਸਥਾਪਨਾ ਕੀਤੀ ਸੀ ਅਤੇ ਇਸ ਦਾ ਨਾਮ ਉਨ੍ਹਾਂ ਨੇ ਆਪਣੇ ਬੇਟੇ ਰੂਪ ਸਿੰਘ ਦੇ ਨਾਮ ਤੋਂ ਰੂਪਨਗਰ ਰੱਖਿਆ ਸੀ